ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਂ ਫਿਰੋਜ਼ਪੁਰ ਕਲਾਂ ਜ਼ਿਲ੍ਹਾ ਪਠਾਨਕੋਟ ਵਿਖੇ ਰਹਿੰਦਾ ਹਾਂ ਮੈਂ ਇੱਕ ਸਰਕਾਰੀ ਅਧਿਆਪਕ ਹਾਂ ਮੇਰੇ ਦੋਸਤ ਰੋਸ਼ਨ ਪਠਾਨੀਆ ਜੀ ਨੇ ਇੱਕ ਦਿਨ ਮੈਨੂੰ ਦੱਸਿਆ ਕਿ ਸਰ ਅੱਜ ਕੱਲ੍ਹ ਸਰਕਾਰੀ ਪ੍ਰਾਈਵੇਟ ਕੰਪਨੀਆਂ ਵੱਲੋਂ ਇੰਨੀ ਸਹੂਲਤ ਦਿੱਤੀ ਜਾ ਰਹੀ ਹੈ ਕਿ ਅਸੀਂ ਆਨਲਾਈਨ ਘਰ ਬੈਠੇ ਹੀ ਕਈ ਕੁਝ ਮੰਗਵਾ ਸਕਦੇ ਹਾਂ ਜਦੋਂ ਮੈਂ ਇੰਨੀ ਗੱਲ ਸੁਣੀ ਤਾਂ ਮੇਰਾ ਮਨ ਬੜਾ ਹੀ ਉਤਾਵਲਾ ਹੋਇਆ ਅਤੇ ਮੈਂ ਵੀ ਔਨਲਾਈਨ ਸਮਾਨ ਘਰ ਤੱਕ ਪਹੁੰਚਾਉਣ ਦੇ ਕਈ ਤਰ੍ਹਾਂ ਦੇ ਰਿਵਿਊ ਦੇਖੇ ਜਿਸ ਵੈਬਸਾਈਟ ਵਿੱਚ ਮੈਂ ਦੇਖਿਆ ਕਿ ਕੁਝ ਚੀਜ਼ਾਂ ਉਸ ਵਿੱਚ ਹਨ ਜਦੋਂ ਮੈਂ ਦੇਖੀਆਂ ਤਾਂ ਇੱਕ ਪਰਸ ਬੜਾ ਹੀ ਵਧੀਆ ਸੀ ਮੈਂ ਉਸ ਦੇ ਇਸ ਰਿਵਿਊ ਤੋਂ ਚੈੱਕ ਕੀਤਾ ਉਸ ਦੇ ਰਿਵਿਊ ਬੜੇ ਚੰਗੇ ਸਨ ਉਸ ਵਿੱਚ ਚੀਜ਼ਾਂ ਬੜੀਆਂ ਹੀ ਵਧੀਆ ਸਨ ਮੈਂ ਸਾਰੀ ਡਿਟੇਲ ਨੂੰ ਚੰਗੀ ਤਰ੍ਹਾਂ ਘੋਖ ਕੇ ਅੰਤ ਵਿੱਚ ਉਸ ਦਾ ਆਰਡਰ ਕਰ ਹੀ ਦਿੱਤਾ ਅਤੇ ਮੈਂ ਉਸ ਦਾ ਔਨਲਾਈਨ ਭੁਗਤਾਨ ਵੀ ਕੀਤਾ ਪਰ ਮੈਨੂੰ ਬੜੀ ਬੇਸਬਰੀ ਨਾਲ ਉਸ ਦੀ ਉਡੀਕ ਹੋ ਰਹੀ ਸੀ ਕੁਝ ਦਿਨ ਹੋਏ ਜਦੋਂ ਕਿ ਮੈਨੂੰ ਮੇਰਾ ਘਰ ਡਿਟੇਲ ਵਿੱਚ ਉਹ ਔਨਲਾਈਨ ਪਰਸ ਪੁੱਜ ਗਿਆ ਮੈਂ ਉਸ ਨੂੰ ਟ੍ਰੈਕ ਕੀਤਾ ਅਤੇ ਜੋ ਮੇਰਾ ਆਰਡਰ ਸੀ ਉਹ ਮੇਰੇ ਕੋਲ ਜਦੋਂ ਪਹੁੰਚਿਆ ਅਤੇ ਪਹਿਲੀ ਗੱਲ ਉਹ ਸਮੇਂ ਸਿਰ ਆਉਣ 'ਤੇ ਹੀ ਮੈਨੂੰ ਖੁਸ਼ੀ ਹੋਈ ਕਿ ਜਿਸ ਤਰ੍ਹਾਂ ਉਹ ਪਹਿਲਾਂ ਹੀ ਮੈਸੇਜ ਕਰ ਦਿੰਦੇ ਹਨ ਕਿ ਤੁਹਾਡਾ ਸਮਾਨ ਇੰਨੀ ਤਰੀਕ ਨੂੰ ਇੰਨੇ ਵਜੇ ਤੁਹਾਡੇ ਕੋਲ ਪਹੁੰਚ ਜਾਏਗਾ ਮੈਂ ਜਦੋਂ ਉਸ ਪਾਰਸਲ ਨੂੰ ਫੜਿਆ ਘਰ ਲਿਆ ਕੇ ਖੋਲ੍ਹਿਆ ਤਾਂ ਉਹ ਉਸ ਪਾਰਸਲ ਦੀ ਪੈਕਿੰਗ ਇੰਨੀ ਵਧੀਆ ਸੀ ਕਿ ਉਹ ਮੈਨੂੰ ਬੜਾ ਹੀ ਚੰਗਾ ਲੱਗਿਆ ਉਹਦੇ ਨਾਲ ਇੱਕ ਬਿੱਲ ਸੀ ਬਿੱਲ ਵਿੱਚ ਪੂਰੀ ਡਿਟੇਲ ਸੀ ਕਿ ਕਿਸ ਕਿਸ ਤਰ੍ਹਾਂ ਅਸੀਂ ਉਸ ਦੇ ਬਿੱਲ ਨੂੰ ਬਣਾਇਆ ਸੀ ਜਿਸ ਵਿੱਚ ਜੀ ਐਸ ਟੀ ਸੀ ਜੀ ਐਸ ਟੀ ਆਦਿ ਚੀਜ਼ਾਂ ਸਨ ਜਦੋਂ ਮੈਂ ਉਹ ਡੱਬਾ ਖੋਲ੍ਹਿਆ ਤਾਂ ਮੈਂ ਪੂਰੀ ਪੂਰੀ ਡਿਟੇਲ ਚੈੱਕ ਕੀਤੀ ਡੱਬਾ ਖੋਲ੍ਹ ਕੇ ਮੈਂ ਜਦੋਂ ਦੇਖਿਆ ਤਾਂ ਉਹ ਪਰਸ ਇੰਨਾ ਘੈਂਟ ਸੀ ਕਿ ਮੈਨੂੰ ਬੜਾ ਹੀ ਪਸੰਦ ਆਇਆ ਕਿਉਂਕਿ ਉਸ ਦੀ ਬਣਾਵਟ ਵਿਚ ਉਹ ਚਮੜਾ ਬਹੁਤ ਹੀ ਵਧੀਆ ਸੀ ਇੰਨਾ ਮੁਲਾਇਮ ਮੈਂ ਕਦੀ ਵੀ ਪਰਸ ਨਹੀਂ ਦੇਖਿਆ ਜੋ ਕਿ ਮੈਨੂੰ ਬੜਾ ਹੀ ਪਸੰਦ ਆਇਆ ਉਹ ਕਾਲੇ ਰੰਗ ਦਾ ਪਰਸ ਸੀ ਉਸ ਦੀ ਬਣਾਵਟ ਮੈਂ ਤੁਹਾਨੂੰ ਦੱਸਣ ਲਈ ਬੜਾ ਹੀ ਚਿੰਤਤ ਹੋ ਰਿਹਾ ਹਾਂ ਕਿ ਉਹ ਕਿਸੇ ਖ਼ਾਸ ਮਸ਼ੀਨਰੀ ਦੁਆਰਾ ਤਿਆਰ ਕੀਤਾ ਗਿਆ ਸੀ ਉਸ ਦਾ ਵਰੰਟੀ ਕਾਰਡ ਵੀ ਮੇਰੇ ਕੋਲ ਆਇਆ ਮੈਂ ਉਸ ਨੂੰ ਉਸ ਦੇ ਵਰੰਟੀ ਕਾਰਡ ਨੂੰ ਸਾਹਮਣੇ ਸਾਂਭ ਕੇ ਰੱਖਿਆ ਪਹਿਲਾਂ ਕੁਝ ਚਿਰ ਉਸ ਵਿੱਚ ਮੈਂ ਹੁਣ ਦੇਖਿਆ ਕਿ ਉਸ ਵਿੱਚ ਅੱਠ ਦਸ ਜੇਬਾਂ ਬਣੀਆਂ ਹੋਈਆਂ ਹਨ ਜਿਹਦੇ ਵਿੱਚ ਵੱਖਰਾ ਵੱਖਰਾ ਸਮਾਨ ਪਾਇਆ ਜਾ ਸਕਦਾ ਹੈ ਇੱਕ ਪਾਸੇ ਜਿਪ ਵਾਲਾ ਖਾਨਾ ਹੈ ਜਿਸ ਵਿੱਚ ਅਸੀਂ ਆਪਣੀਆਂ ਜ਼ਰੂਰੀ ਚੀਜ਼ਾਂ ਛੋਟੀਆਂ ਛੋਟੀਆਂ ਰੱਖ ਸਕਦੇ ਹਾਂ ਕੋਈ ਪਰਚੀ ਕੋਈ ਚਾਬੀ ਕੋਈ ਹੋਰ ਚੇਂਜ ਵਗੈਰਾ ਰੱਖ ਸਕਦੇ ਹਾਂ ਇੱਕ ਪਾਸੇ ਇੱਕ ਖਾਨਾ ਬਣਿਆ ਹੈ ਜਿਸ ਵਿੱਚ ਆਈ ਕਾਰਡ ਪੈਨ ਕਾਰਡ ਏ ਟੀ ਐਮ ਕਾਰਡ ਆਦਿ ਰੱਖਣ ਦੀ ਜਗ੍ਹਾ ਬੜੀ ਹੀ ਵਧੀਆ ਹੈ ਜਦੋਂ ਮੈਂ ਇਸ ਪਰਸ ਨੂੰ ਦੇਖਦਾ ਹਾਂ ਤਾਂ ਮੈਨੂੰ ਇਹ ਪਰਸ ਬੜਾ ਹੀ ਪਸੰਦ ਲੱਗਦਾ ਹੈ ਇਸ ਪਰਸ ਦੇ ਕਾਰਨ ਮੈਂ ਮੇਰਾ ਮਨ ਕਈ ਵਾਰ ਜਾਗ ਉੱਠਦਾ ਹੈ ਕਿ ਕੁਛ ਹੋਰ ਵੀ ਆਰਡਰ ਕੀਤਾ ਜਾਏ ਕਿ ਮੈਂ ਇਸ ਤਰ੍ਹਾਂ ਹੀ ਮੈਂ ਇੱਕ ਬੈਲਟ ਦਾ ਆਰਡਰ ਵੀ ਥੋੜ੍ਹੇ ਦੇਰ ਪਹਿਲਾਂ ਕੀਤਾ ਹੈ ਕਿਉਂਕਿ ਮੈਨੂੰ ਪਰਸ ਚੰਗਾ ਲੱਗਾ ਹੈ ਇਸ ਕਰਕੇ ਮੈਂ ਇਸ ਚੀਜ਼ ਨੂੰ ਪਸੰਦ ਕਰਦਾ ਹਾਂ ਕਿ ਜੋ ਵੀ ਚੀਜ਼ ਔਨਲਾਈਨ ਮੰਗਵਾਈ ਜਾਏ ਉਸ ਦੀ ਪਹਿਲਾਂ ਫੋਟੋ ਦੇਖੀ ਜਾਏ ਫਿਰ ਉਸ ਚੀਜ਼ ਨੂੰ ਫੋਨ ਵਿੱਚ ਹੀ ਚੰਗੀ ਤਰ੍ਹਾਂ ਸਰਚ ਕੀਤਾ ਜਾਏ ਸਾਰਾ ਕੁਝ ਪਤਾ ਚੱਲ ਜਾਂਦਾ ਹੈ ਅਤੇ ਅੱਜ ਕੱਲ੍ਹ ਲੋਕ ਲੋਕਾਂ ਦਾ ਇਹ ਟਰੈਂਡ ਬੜਾ ਹੀ ਚੱਲ ਰਿਹਾ ਹੈ ਕਿ ਔਨਲਾਈਨ ਸ਼ੋਪਿੰਗ ਕੀਤੀ ਜਾਏ ਅਤੇ ਮੈਂ ਵੀ ਇਸ ਪਰਸ ਨੂੰ ਮੰਗਵਾ ਕੇ ਇੰਨਾ ਖੁਸ਼ ਹੋ ਗਿਆ ਹਾਂ ਕਿ ਮੈਂ ਹੁਣ ਕਾਫੀ ਸਮਾਨ ਔਨਲਾਈਨ ਮੰਗਵਾ ਰਿਹਾ ਹਾਂ ਵਾਕਿਆ ਹੀ ਪਰਸ ਦੇਖਣਯੋਗ ਹੈ ਸੰਭਾਲਣਯੋਗ ਹੈ ਅਤੇ ਬਹੁਤ ਹੀ ਵਧੀਆ ਹੈ ਧੰਨਵਾਦ